ਬੇਸ਼ੱਕ ਦੀ ਮੈਂ ਸ਼ਹਿਰਾਂ ਵਿੱਚ ਰਹਿੰਦਾ ਹਾਂ ਪਰ ਅੱਜ ਵੀ ਜੀਅ ਕਰਦਾ ਹੈ ਕਿ ਪਿੰਡ ਨੂੰ ਚੱਲੀਏ ਕਿਉਂਕਿ ਪਿੰਡ ਦਾ ਜੋ ਵੀ ਮਾਹੌਲ ਹੈ ਉਹ ਵਧੀਆ ਲੱਗਦਾ ਹੈ ਕਿਉਂਕਿ ਪਿੰਡ ਦੇ ਜਿੰਨੇ ਵੀ ਭੈਣ ਭਾਈ ਹਨ ਜਿੰਨੇ ਵੀ ਤਾਏ ਚਾਚੇ ਹਨ ਉਹ ਹਰ ਵਕਤ ਇਕੱਠੇ ਰਹਿੰਦੇ ਹਨ ਹਰ ਇੱਕ ਦੇ ਦੁੱਖ ਸੁੱਖ ਵਿੱਚ ਖੜ੍ਹਦੇ ਹਨ ਹਰੇਕ ਤਿਉਹਾਰ ਦੇ ਮੌਕੇ 'ਤੇ ਹਮੇਸ਼ਾ ਇਕੱਠੇ ਰਹਿੰਦੇ ਹਨ ਪਿੰਡ ਵਿੱਚ ਆਮ ਤੌਰ 'ਤੇ ਇੱਕ ਤਾਂ ਖੁੱਲ੍ਹੇ ਡੁੱਲੇ ਘਰ ਹੁੰਦੇ ਹਨ ਅਤੇ ਦੂਜੀ ਗੱਲ ਇਹ ਇੰਨੀ ਕੁ ਹੈ ਕਿ ਲੜਾਈ ਪੜ੍ਹਾਈਆਂ ਤੋਂ ਬਹੁਤ ਜ਼ਿਆਦਾ ਦੂਰ ਹਨ ਸ਼ਹਿਰਾਂ ਦੇ ਵਿੱਚ ਮਾਹੌਲ ਥੋੜ੍ਹਾ ਜਿਹਾ ਖਰਾਬ ਹੁੰਦਾ ਹੈ ਪਰ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਬਿਲਕੁਲ ਵੀ ਮਾਹੌਲ ਨਹੀਂ ਹੁੰਦਾ ਪਿੰਡਾਂ ਦਾ ਮਾਹੌਲ ਅਤੇ ਵਾਤਾਵਰਨ ਤਾਂ ਬਹੁਤ ਹੀ ਜ਼ਿਆਦਾ ਸ਼ੁੱਧ ਹੈ ਸ਼ਹਿਰਾਂ ਦੇ ਨਾਲੋਂ ਪਿੰਡ ਵਿੱਚ ਆਮ ਤੌਰ 'ਤੇ ਜਿੰਨੇ ਵੀ ਘਰ ਹਨ ਉਹ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਹਨ ਸ਼ਹਿਰਾਂ ਦੇ ਵਿੱਚ ਇੱਕ ਇੱਕ ਜਣਾ ਰਹਿੰਦਾ ਹੈ ਜਾਂ ਇੱਕ ਇੱਕ ਛੋਟੀ ਫੈਮਲੀ ਕਹਿ ਸਕਦੇ ਹਾਂ ਉਹ ਰਹਿੰਦੀ ਹੈ ਪਿੰਡ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਰਹਿੰਦਾ ਹੈ ਕੋਈ ਵੀ ਦੁੱਖ ਸੁੱਖ ਦੀ ਘੜੀ ਆਉਂਦੀ ਹੈ ਪਿੰਡਾਂ ਵਿੱਚ ਉਹ ਨਾਲ ਖੜ੍ਹਦੇ ਹਨ ਅਤੇ ਤਿਉਹਾਰਾਂ ਦੇ ਮੌਕੇ 'ਤੇ ਵੀ ਜਾਂ ਹੋਰ ਵੀ ਪਿੰਡ ਵਿੱਚ ਕੋਈ ਵੀ ਕੰਮ ਹੋਵੇ ਕੋਈ ਸੰਸਥਾ ਸਕੂਲਾਂ ਜਾਂ ਹੋਰ ਵੀ ਕੋਈ ਵੀ ਨਿੱਜੀ ਕੰਮ ਹੋਵੇ ਤਾਂ ਜਿੰਨੇ ਵੀ ਪਿੰਡ ਦੇ ਲੋਕ ਹਨ ਸਾਰੇ ਰਲ ਮਿਲ ਕੇ ਕਰਦੇ ਹਨ ਪਰ ਸ਼ਹਿਰਾਂ ਦੇ ਵਿੱਚ ਆਮ ਤੌਰ 'ਤੇ ਇਕੱਲੇ ਇਕੱਲੇ ਹੀ ਰਹਿੰਦੇ ਹਨ ਇਸ ਲਈ ਸਾਨੂੰ ਜਾਂ ਮੈਨੂੰ ਪਿੰਡ ਵਿੱਚ ਰਹਿਣਾ ਪਸੰਦ ਹੈ ਕਿਉਂਕਿ ਅੱਜ ਅਸੀਂ ਸ਼ਹਿਰਾਂ ਵਿੱਚ ਆ ਗਏ ਪਰ ਸਾਨੂੰ ਅੱਜ ਵੀ ਪਿੰਡ ਦੀ ਯਾਦ ਬਹੁਤ ਆਉਂਦੀ ਹੈ